ਜਲੰਧਰ ਜਿਲ੍ਹੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਬਹੁਤ ਵਧੀਆ ਐ ਇੱਥੇ ਜਿਹੜੀਆਂ ਡਾਕਟਰੀ ਸਹੂਲਤਾਂ ਤੇ ਸੇਵਾਵਾਂ ਨੇ ਬਹੁਤ ਉਪਵਲਬੰਧ ਨੇ ਅਤੇ ਉਹ ਸਥਾਨਕ ਭਾਈਚਾਰੇ ਜਿਵੇਂ ਦੀਆ ਲੋੜਾਂ ਬ ਬਹੁਤ ਵਧੀਆ ਪੂਰੀਆਂ ਕਰਦੀਆਂ ਨੇ ਇੱਥੇ ਕਾਫ਼ੀ ਜਿਵੇਂ ਕਿਡਨੀ ਦੀਆਂ ਦਵਾਈਆਂ ਫ੍ਰੀ ਮਿਲਦੀਆਂ ਨੇ ਡਾਕਟਰੀ ਸਹੂਲਤਾਂ ਜਦੋਂ ਮਰਜੀ ਚਲੇ ਜਾਓ ਓਦੋਂ ਮਿਲ ਜਾਂਦੀਆਂ ਨੇ ਇੱਥੇ ਕਿੰਨੀਆਂ ਨਿੱਕੀਆਂ ਨਿੱਕੀਆਂ ਖੁੱਲ ਗਈਆਂ ਨੇ ਡਿਸਪੈਂਸਰੀਆਂ ਜਿੱਥੇ ਸਾਡੇ ਪ੍ਰਧਾ ਮਾਨ ਸਾਬ ਨੇ ਫ੍ਰੀ ਦਵਾਈ ਦਿੱਤੀ ਐ ਤੇ ਕਈ ਜਗਾ ਤੇ ਤਾਂ ਏਦਾਂ ਦੇ ਨੇ ਕੀ ਜਿਵੇਂ ਕਿ ਪਤ ਪੱਥਰੀ ਦੀ ਦਵਾਈ ਫ੍ਰੀ ਮਿਲਦੀ ਐ ਹੋਰ ਵੀ ਕਈ ਐਹੋ ਜਿਹੀਆਂ ਦਵਾਈਆਂ ਨੇ ਜਿਹੜੀਆਂ ਫ੍ਰੀ ਮਿਲਦੀਆਂ ਨੇ ਤੇ ਇੱਥੇ ਮੈਡੀਸਨ ਸੈਂਟਰ ਐਮਰਜੰਸੀ ਜਦੋਂ ਵੀ ਕਵੋ ਓਸੇ ਟੈਮ ਐਮ ਐਮਰਜੰਸੀ ਵਾਸਤੇ ਬੁਲਾਓ ਓਸੇ ਟੈਮ ਆ ਜਾਂਦੇ ਨੇ ਐਮਰਜੰਸੀ ਲਈ ਤੇ ਐਥੇ ਸਿਹਤ ਸੰਭਾਲ ਡਾਕਟਰੀ ਸਹੇਲਤਾਂ ਬਹੁਤ ਵਧੀਆ ਨੇ ਡਾਕਟਰ ਵੀ ਆਪਸ ਵਿੱਚ ਭਾਈਚਾਰੇ ਨਾਲ਼ ਲੋੜਾਂ ਵਧੀਆ ਪੂਰੀਆਂ ਕਰਦੇ ਨੇ ਜਿਹੜੀਆਂ ਸਰਕਾਰੀ ਜਿਹੜੀ ਡਾਕਟਰੀ ਸਹੂਲਤਾਂ ਨੇ ਓਥੇ ਵੀ ਬਹੁਤ ਵਧੀਆ ਓਨਾਂ ਨੇ ਡਾਕਟਰ ਰੱਖੇ ਹੋਏ ਨੇ ਜਿਹੜੇ ਕਿ ਬੜੀ ਵਧੀਆ ਗੱਲ ਸੁਣਦੇ ਨੇ ਤੇ ਬਹੁਤ ਵਧੀਆ ਦਵਾਈ ਦਿੰਦੇ ਨੇ ਕੋਈ ਜਿਆਦਾ ਪੈਸੇ ਵੀ ਨੀ ਕੋਈ ਪਰਚੀ ਦੇ ਜਿਵੇਂ ਸਿਵਲ ਹਸਪਤਾਲ ਵਿੱਚ ਵੀ ਕਾਫ਼ੀ ਫ੍ਰੀ ਵਿੱਚ ਵੀ ਇਲਾਜ ਹੁੰਦਾ ਐ ਕੋਈ ਥੋੜੇ ਬਹੁਤੇ ਪੈਸਿਆਂ ਨਾਲ਼ ਟੈਸਟ ਵੀ ਹੋ ਜਾਂਦੇ ਨੇ ਇਸ ਕਰਕੇ ਐਥੇ ਸਿਹਤ ਸੰਭਾਲ ਪ੍ਰਣਾਲੀ ਬੜੀ ਵਧੀਆ ਐ ਧੰਨਵਾਦ